ਸਾਨੂੰ ਹਰ ਤਰ੍ਹਾਂ ਦੇ ਪੌਦੇ ਲਗਾਉ ਉਗਾਉਣੇ ਚਾਹੀਦੇ ਹਨ ਚਾਹੇ ਉਹ ਫੁੱਲ ਹੋਣ ਚਾਹੇ ਫਲ ਹੋਣ ਚਾਹੇ ਸਬਜ਼ੀਆਂ ਕਿਉਂਕਿ ਹਰ ਇੱਕ ਪੌਦੇ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ ਫੁੱਲ ਸਾਨੂੰ ਜਿਸ ਤਰ੍ਹਾਂ ਫੁੱਲ ਖਿੜਦੇ ਹਨ ਸਾਡੀ ਜ਼ਿੰਦਗੀ ਵੀ ਉਹਨਾਂ ਨੂੰ ਵੇਖ ਕੇ ਖਿੜਦੀ ਫਲ ਫਲ ਹਰਤਾ ਫਲ ਜੋ ਵੀ ਹੈ ਫਲ ਸਾਡੇ ਜੀਵਨ ਨੂੰ ਸਾਡੇ ਸਰੀਰ ਨੂੰ ਬਹੁਤ ਹੀ ਤੰਦਰੁਸਤ ਰੱਖਦੇ ਹਨ ਹਮੇਸ਼ਾ ਸਾਨੂੰ ਫਲਾਂ ਦਾ ਹੀ ਫਲਾਂ ਨੂੰ ਖਾਣਾ ਚਾਹੀਦਾ ਹੈ ਜ਼ਿਆਦਾਤਰ ਲੋਕ ਅੱਜ ਕੱਲ ਦੁਨੀਆ ਦੇ ਵਿੱਚ ਵੀ ਖਾਣਾ ਲੋਕ ਬਹੁਤ ਘੱਟ ਖਾਂਦੇ ਹਨ ਫਲ ਸਬਜ਼ੀਆਂ ਨੂੰ ਤਹਿਜ਼ੀਬ ਦਿੰਦੇ ਹਨ ਉਹਨਾਂ ਨੂੰ ਟਰਾ ਕਰਦੇ ਹਨ ਉਹਨਾਂ ਨੂੰ ਖਾਣਾ ਚਾਹੁੰਦੇ ਹਨ ਇਸ ਕਰਕੇ ਸਾਨੂੰ ਹਰ ਇੱਕ ਕਿਸਮ ਦਾ ਪੌਦਾ ਹਰ ਕਿਸਮ ਦਾ ਫੁੱਲ ਫਲ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ ਇੱਕ ਆਪਣੇ ਜ਼ਿੰਦਗੀ ਦੇ ਵਿੱਚ ਇੱਕ ਸਾਡਾ ਹੋ ਓ ਸਾਨੂੰ ਹੋਣਾ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਛ ਕਰੀਏ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੈ ਅਸੀਂ ਬਾਗ ਇੱਕ ਬਣਾ ਸਾਨੂੰ ਇੱਕ ਬਾਗ ਬਣਾਉਣਾ ਚਾਹੀਦਾ ਬਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਲਗਾਉਣੇ ਚਾਹੀਦੇ ਨੇ ਫਲ ਫਲ ਸਬਜ਼ੀਆਂ ਸਭ ਤਰ੍ਹਾਂ ਹਰ ਚੀਜ਼ ਲਗਾਉਣੀ ਚਾਹੀਦੀ ਹੈ ਗਰਾ ਜੋ ਥੱਲੇ ਗਰੀਨਰੀ ਹੁੰਦੀ ਨੀਚੇ ਉਹਨੂੰ ਵੈਸੇ ਵੀ ਬਾਗ ਨੂੰ ਵੇਖ ਕੇ ਬੈਗ ਬਾਗ ਦੇ ਵਿੱਚ ਸੈਰ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਜਿਸ ਨੂੰ ਸਾਨੂੰ ਜਿਸ ਲਈ ਸਾਨੂੰ ਦਵਾਈਆਂ ਦੀ ਲੋੜ ਹੀ ਨਹੀਂ ਪੈਂਦੀ ਇਸ ਕਰਕੇ ਸਵੇਰ ਦੀ ਸੈਰ ਸ਼ਾਮ ਦੀ ਸੈਰ ਅਸੀਂ ਬੜੇ ਬਹੁਤ ਅਸੀਂ ਇਹਨੂੰ ਚੀਜ਼ ਨੂੰ ਵਧੀਆ ਸਮਝਦੇ ਹਾਂ ਕਿ ਸਵੇਰ ਦੀ ਸੈਰ ਸ਼ਾਮ ਦੀ ਸੈਰ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਦਗੀ ਲਈ ਇਸ ਕਰਕੇ ਸਾਨੂੰ ਆਪਣੇ ਜੀਵਨ ਵਿੱਚ ਇੱਕ ਬਗੀਚਾ ਤਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਪੌਦੇ ਉਗਾਉਣੇ ਚਾਹੀਦੇ ਹਨ ਜੋ ਕਿ ਸਾਡੇ ਜ਼ਿੰਦਗੀ ਲਈ ਬਹੁਤ ਹੀ ਮਹੱਤਵ ਰੱਖਦੇ ਹਨ